ਜਦੋਂ ਮੈਂ ਪਹਾੜਾਂ 'ਤੇ ਘੁੰਮਣ ਗਿਆ ਉੱਥੇ ਜਾਣ ਸਾਰ ਹੀ ਮੈਂ ਬਿਮਾਰ ਹੋ ਗਿਆ ਉੱਥੇ ਕੋਈ ਡਾਕਟਰ ਵੀ ਨਹੀਂ ਲੱਭਿਆ ਅਸੀਂ ਹਰੇਕ ਥਾਂ 'ਤੇ ਭਾਲਦੇ ਰਹੇ ਫਿਰ ਮੇਰੇ ਦਿਮਾਗ 'ਚ ਇੱਕ ਤਰਕੀਬ ਆਈ ਕਿ ਮੈਂ ਆਪਣਾ ਫੋਨ ਖੋਲ੍ਹਾਂ ਅਤੇ ਇਸ 'ਤੇ ਸਰਚ ਕਰਾਂ ਮੈਂ ਆਪਣੇ ਫੋਨ ਵਿੱਚ ਗੂਗਲ ਮੈਪ ਖੋਲ੍ਹਿਆ ਅਤੇ ਸਰਚ ਕੀਤਾ ਕਿ ਡਾਕਟਰ ਨਜ਼ਦੀਕ ਉਸ ਨੇ ਕਈ ਸਾਰੇ ਕਲੀਨਿਕ ਕੱਢ ਦਿੱਤੇ ਉਸ ਤੋਂ ਇੱਕ ਕਲੀਨਿਕ 'ਤੇ ਮੈਂ ਕਲਿੱਕ ਕਰ ਦਿੱਤਾ ਅਤੇ ਉਸਦੀ ਡਾਇਰੈਕਸ਼ਨ ਲਗਾ ਕੇ ਅਸੀਂ ਚੱਲ ਪਏ ਉਹ ਸਾਡੀ ਲਕੇਸ਼ਨ ਤੋਂ ਪੈਂਤੀ ਕਿਲੋਮੀਟਰ ਦੀ ਦੂਰੀ 'ਤੇ ਸੀ ਅਸੀਂ ਉਸ ਦੀ ਡਾਇਰੈਕਸ਼ਨ ਦੇ ਹਿਸਾਬ ਨਾਲ ਜਾਈ ਗਏ ਕਦੇ ਉਹ ਕਹਿ ਦਿਆ ਕਰੇ ਉੱਤਰ ਦਿਸ਼ਾ ਵੱਲੋਂ ਮੁੜੋ ਕਦੇ ਕਹਿ ਦਿਆ ਕਰੇ ਦੱਖਣ ਦਿਸ਼ਾ ਵੱਲ ਮੁੜੋ ਉਸਨੇ ਰਾਹ ਵੀ ਬਹੁਤ ਸਹੀ ਦੱਸਿਆ ਅਤੇ ਰਾਹ ਟੁੱਟੇ ਵੀ ਨਹੀਂ ਸਨ ਪਰ ਵਿੱਚ ਟੋਲ ਜ਼ਰੂਰ ਪੈਂਦਾ ਸੀ ਕਿਉਂਕਿ ਐਨ ਐਚ ਸੈਵਨ ਵਿੱਚ ਜਾਂ ਕੋਈ ਵੀ ਨੈਸ਼ਨਲ ਹਾਈਵੇ ਵਿੱਚ ਟੋਲ ਤਾਂ ਪੈਂਦਾ ਹੀ ਹੈ ਫਿਰ ਜਦੋਂ ਅਸੀਂ ਜਾਈ ਗਏ ਜਾਈ ਗਏ ਤਦ ਅਸੀਂ ਉੱਥੇ ਜਾ ਕੇ ਪਹੁੰਚ ਗਏ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਵੀ ਫੋਨਾਂ ਨੇ ਸਾਡੀ ਜ਼ਿੰਦਗੀ ਬਹੁਤ ਸੌਖੀ ਕਰ ਦਿੱਤੀ ਹੈ ਅਤੇ ਜੋ ਇਸ ਵਿੱਚ ਐਪਲੀਕੇਸ਼ਨ ਗੂਗਲ ਮੈਪ ਸੀ ਉਸਨੇ ਤਾਂ ਡਾਕਟਰ ਨੂੰ ਲੱਭਣਾ ਹੋਰ ਵੀ ਸੌਖਾ ਕਰ ਦਿੱਤਾ ਉਸ ਨਾਲ ਮੈਨੂੰ ਬਹੁਤ ਮਦਦ ਹੋਈ ਨਹੀਂ ਅਸੀਂ ਉੱਥੇ ਹੀ ਖੱਜਲ ਹੋਈ ਜਾਂਦੇ